ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਵੇਂ ਕਿ ਕਿਸਾਨਾਂ ਨੂੰ ਬਹੁਤ ਹੀ ਘੱਟ ਵਿਆਜ 'ਤੇ ਆਸਾਨੀ ਨਾਲ ਪੈਸੇ ਮਿਲ ਜਾਂਦੇ ਹਨ ਅਤੇ ਉਸ ਤੋਂ ਜਿਵੇਂ ਕਿ ਘਰ ਪਾਉਣ ਲਈ ਵੀ ਬਹੁਤ ਘੱਟ ਵਿਆਜ 'ਤੇ ਪੈਸੇ ਮਿਲਦੇ ਹਨ ਜੋ ਕਿ ਸਰਕਾਰ ਦਿੰਦੀ ਹੈ ਇਵੇਂ ਬਹੁਤ ਜ਼ਿਆਦਾ ਸਕੀਮਾਂ ਨੇ ਜੋ ਕਿ ਸਰਕਾਰ ਦੀਆਂ ਸਰਕਾਰ ਨੇ ਚਲਾਈਆਂ ਹੋਈਆਂ ਹਨ ਅਤੇ ਜਿਵੇਂ ਕਿ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਕਿ ਕੁੜੀਆਂ ਆਉਂਦੀਆਂ ਉਨ੍ਹਾਂ ਦੀਆਂ ਫੀਸਾਂ ਬਹੁਤ ਹੀ ਜ਼ਿਆਦਾ ਘੱਟ ਕੀਤੀਆਂ ਹੋਈਆਂ ਨੇ ਅਤੇ ਉਨ੍ਹਾਂ ਨੂੰ ਜਿਵੇਂ ਕਿ ਸਾਈਕਲ ਸਾਈਕਲ ਵੀ ਦਿੱਤੇ ਨੇ ਸਰਕਾਰ ਨੇ ਹੋਰ ਵੀ ਵਜ਼ੀਫੇ ਵਗੈਰਾ ਵੀ ਮਿਲਦੇ ਦਿੰਦੀ ਹੈ ਸਰਕਾਰ ਉਨ੍ਹਾਂ ਨੂੰ ਅਤੇ ਜੋ ਬੱਚੇ ਜ਼ਿਆਦਾ ਵਧੀਆ ਪ ਅਟੈਲੀਜੈਂਟ ਨੇ ਜ਼ਿਆਦਾ ਪੜ੍ਹਦੇ ਨੇ ਉਨ੍ਹਾਂ ਨੂੰ ਸਮਾਰਟ ਫੋਨ ਅਤੇ ਲੈਪਟਾਪ ਲੈਪਟਾਪ ਵੀ ਦਿੱਤੇ ਹੋਏ ਹਨ ਇਵੇਂ ਹੀ ਬਹੁਤ ਜ਼ਿਆਦਾ ਸਹੂਲਤਾਂ ਸਰਕਾਰ ਦਿੰਦੀ ਹੈ ਬੱਚਿਆਂ ਨੂੰ ਅਤੇ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਇਸਦਾ ਫਾਇਦਾ ਹੈ ਅਤੇ ਹੋਰ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਨੇ ਉਨ੍ਹਾਂ ਨੂੰ ਵੀ ਬਹੁਤ ਜ਼ਿਆਦਾ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਗਈਆ ਹਨ ਜੋ ਕਿ ਹਰ ਇੱਕ ਨੂੰ ਬਹੁਤ ਜ਼ਿਆਦਾ ਸਕੀਮਾਂ ਦਾ ਫਾਇਦਾ ਹੈ ਅਤੇ ਐਵੇਂ ਹੀ ਹੋਰ ਵੀ ਬਹੁਤ ਜ਼ਿਆਦਾ ਸਕੀਮਾਂ ਚੱਲਦੀਆਂ ਹਨ